ਮੇਰਾ ਨਾਮ ਸੁਰਿੰਦਰ ਸਿੰਘ ਪਿੰਡ ਪੰਜੋਲਾ ਡਾਕਖਾਨਾ ਮੋੜੇਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹਾਂ ਮੈਂ ਸਿਵਲ ਇੰਜਨੀਅਰਿੰਗ ਦਾ ਡਿਪਲੋਮਾ ਕੀਤਾ ਹੋਇਆ ਹੈ ਇਸ ਤੋਂ ਬਿਨਾਂ ਗ੍ਰੈਜੂਏਸ਼ਨ ਵੀ ਕੀਤੀ ਹੋਈ ਹੈ ਅਤੇ ਮੇਰੀ ਉਮਰ ਲਗਭਗ ਛਿਆਲ਼ੀ ਸਾਲ ਦੀ ਹੋ ਚੁੱਕੀ ਹੈ ਇਸ ਸਮੇਂ ਮੈਂ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੇ ਵਿੱਚ ਬਤੌਰ ਏ ਜੇਈ ਕੰਮ ਸਟੇਟ ਆਫਸਰ ਦੀ ਪੋਸਟ 'ਤੇ ਕੰਮ ਕਰ ਰਿਹਾ ਹਾਂ